ਨਮਸ਼ਕਾਰ ਜੀ ਕੀ ਮੈਂ ਖਾਲਸਾ ਟੈਕਸੀ ਸਟੈਂਡ ਤੋਂ ਗੱਲ ਕਰ ਰਿਹਾ ਹਾਂ ਸਰ ਮੈਂ ਤੁਹਾਡੇ ਬੁਕਿੰਗ ਤੁਹਾਡੇ ਟੈਕਸੀ ਸਟੈਂਡ ਤੋਂ ਇੱਕ ਟੈਕਸੀ ਬੁੱਕ ਕਰਵਾਈ ਸੀ ਪਿਛਲੇ ਹਫ਼ਤੇ ਜਿਸ ਲਈ ਮੈਂ ਅੱਜ ਸ਼ਿਮਲੇ ਜਾਣਾ ਸੀਗਾ ਆਪਣੇ ਪੰਜ ਸੱਤ ਦੋਸਤਾਂ ਨਾਲ ਅਤੇ ਟੈਕਸੀ ਡਰਾਈਵਰ ਨੇ ਸਾਨੂੰ ਸਵੇਰੇ ਨੌ ਵਜੇ ਦਾ ਟੈਮ ਦਿੱਤਾ ਸੀ ਵੀ ਉਹ ਨੌ ਵਜੇ ਆ ਜਾਵੇਗਾ ਹੁਣ ਸਾਢੇ ਦਸ ਤੋਂ ਉੱਪਰ ਟੈਮ ਹੋ ਚੁੱਕਾ ਹੈ ਅਤੇ ਅਸੀਂ ਲੇਟ ਬਹੁਤ ਹੋ ਚੁੱਕੇ ਹਨ ਅਸੀਂ ਤੁਹਾਡੇ ਦਿੱਤੇ ਨੰਬਰ 'ਤੇ ਕੋਲ ਕਰ ਰਹੇ ਹਨ ਟੈਕਸੀ ਡਰਾਈਵਰ ਨੂੰ ਤਾਂ ਕਿ ਉਹ ਛੇਤੀ ਤੋਂ ਛੇਤੀ ਆਵੇ ਪਰ ਉਹ ਫ਼ੋਨ ਨਹੀਂ ਚੱਕ ਰਿਹਾ ਸਾਡਾ ਅਤੇ ਅਸੀਂ ਜੇ ਉਹਨੂੰ ਮੈਸਿਜ ਵੀ ਕਰ ਰਹੇ ਹਨ ਤਾਂ ਉਹ ਸਾਡਾ ਮੈਸਿਜ ਦਾ ਰਿਪਲਾਈ ਵੀ ਨਹੀਂ ਦੇ ਰਿਹਾ ਹੈ ਜਿਸ ਕਰਕੇ ਸਾਨੂੰ ਬਹੁਤ ਲੇਟ ਹੋ ਚੁੱਕਾ ਹੈ ਤਾਂ ਅਸੀਂ ਚਾਹੁੰਦੇ ਹਨ ਕਿ ਸਾਡੀ ਟੈਕਸੀ ਦੀ ਬੁਕਿੰਗ ਤੁਹਾਡੇ ਖਾਲਸਾ ਟੈਕਸੀ ਸਟੈਂਡ ਤੋਂ ਰੱਦ ਕੀਤੀ ਜਾਵੇ ਅਤੇ ਕਿਰਪਾ ਕਰਕੇ ਮੇਰਾ ਐਡਵਾਂਸ ਦਿੱਤਾ ਪੈਸਾ ਮੈਨੂੰ ਫੇਰ ਮੋੜ ਦਿੱਤਾ ਜਾਵੇ ਧੰਨਵਾਦ ਜੀ